ਪੰਜਾਬੀ ਭਾਸ਼ਾ ਇੱਕ ਅਮੀਰ ਇਤਿਹਾਸ ਵਾਲੀ ਭਾਸ਼ਾ ਹੈ ਜਿਸ ਨੇ ਸਦੀਆਂ ਦੌਰਾਨ ਕਈ ਤਬਦੀਲੀਆਂ ਅਤੇ ਵਿਕਾਸ ਦੇ ਪੜਾਅ ਦੇਖੇ ਹਨ ਇਹ ਭਾਰਤੀ ਆਰਿਆਈ ਭਾਸਾ ਪਰਿਵਾਰ ਨਾਲ ਸੰਬੰਧਿਤ ਹੈ ਇਸ ਦਾ ਮੂਲ ਸੰਸਕ੍ਰਿਤ ਭਾਸ਼ਾ ਨਾਲ ਜੁੜਿਆ ਹੋਇਆ ਹੈ ਲਗਭਗ ਪੰਦਰਾ ਸੋ ਈਸਵ ਪੂਰਵ ਵਿੱਚ ਆਰੀਆਈ ਲੋਕ ਦੇ ਭਾਰਤ ਆਉਣ ਨਾਲ ਇਸ ਖੇਤਰ ਵਿੱਚ ਇੱਕ ਨਵੀਂ ਭਾਸ਼ਾ ਦਾ ਜਨਮ ਹੋਇਆ ਇਸ ਭਾਸ਼ਾ ਦਾ ਸੰਪਰਕ ਸਥਾਨਕ ਭਾਸ਼ਾਵਾਂ ਨਾਲ ਹੋਇਆ ਅਤੇ ਇਸ ਤਰ੍ਹਾਂ ਪੰਜਾਬੀ ਭਾਸ਼ਾ ਦਾ ਬੀਜ ਬੀਜਿਆ ਗਿਆ ਆਰਿਆਈ ਲੋਕ ਆਪਣੇ ਨਾਲ ਵੈਦਿਕ ਭਾਸ਼ਾ ਲਿਆਏ ਸਨ ਇਸ ਭਾਸ਼ਾ ਦਾ ਵਿਕਾਸ ਹੋ ਕੇ ਸੰਸਕ੍ਰਿਤ ਬਣੀ ਪੰਜਾਬੀ ਭਾਸ਼ਾ ਵੀ ਇਸੇ ਸੰਸਕ੍ਰਿਤ ਤੋਂ ਹੀ ਵਿਕਸਿਤ ਹੋਈ ਹੈ ਸੰਸਕ੍ਰਿਤ ਦੇ ਆਮ ਲੋਕਾਂ ਦੁਆਰਾ ਵਰਤੇ ਜਾਣ ਵਾਲੇ ਪ੍ਰਾਕਿਰਤਿਕ ਅਸੰਭਵ ਭਾਸ਼ਾਵਾਂ ਦਾ ਜਨਮ ਹੋਇਆ ਪੰਜਾਬੀ ਭਾਸ਼ਾ ਇਹਨਾਂ ਅੰਪ੍ਰੰਸ਼ਾਂ ਵਿੱਚੋਂ ਹੀ ਵਿਕਸਿਤ ਹੋਈ ਹੈ ਮੁਸਲਮਾਨੀ ਹਮਲਿਆਂ ਨਾਲ ਪੰਜਾਬੀ ਭਾਸ਼ਾ ਵਿੱਚ ਫਾਰਸੀ ਸ਼ਬਦਾਂ ਦਾ ਪ੍ਰਵੇਸ਼ ਹੋਇਆ ਇਸ ਨਾਲ ਭਾਸ਼ਾ ਦੀ ਸ਼ਬਦਾਵਲੀ ਵਿੱਚ ਕਾਫੀ ਵਾਧਾ ਹੋਇਆ ਸਿੱਖ ਧਰਮ ਦੇ ਉਤਾਰ ਨਾਲ ਪੰਜਾਬੀ ਭਾਸ਼ਾ ਨੂੰ ਇੱਕ ਨਵੀਂ ਪਛਾਣ ਮਿਲੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰਮੁਖੀ ਲਿਪੀ ਵਿਚ ਹੋਈ ਜਿਸ ਨਾਲ ਪੰਜਾਬੀ ਭਾਸਾ ਨੂ ਮਜਬੂਰ ਅਧਾਰ ਮਿਲਿਆ ਪੰਜਾਬੀ ਲੋਕ ਸਾਹਿਤ ਜਿਵੇਂ ਗੀਤ ਬੋਲੀਆਂ ਲੋਕ ਕਹਾਣੀਆਂ ਆਦਿ ਨੇ ਪੰਜਾਬੀ ਭਾਸ਼ਾ ਨੂੰ ਅਮੀਰ ਬਣਾਇਆ ਵੱਡੀ ਗਿਣਤੀ ਵਿੱਚ ਪੰਜਾਬੀ ਕਵੀਆਂ ਲੇਖਕਾਂ ਨੇ ਪੰਜਾਬੀ ਭਾਸ਼ਾ ਵਿੱਚ ਅਮੀਰ ਸਿਰਜਿਆ ਪੰਜਾਬੀ ਭਾਸ਼ਾ ਦੀਆਂ ਕਈ ਬੋਲੀਆਂ ਜਿਵੇਂ ਮਾਝੀ ਮਲਵਈ ਦੁਆਬੀ ਆਦੀ ਦਾ ਵਿਕਾਸ ਹੋਇਆ ਵੀਹ ਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਦੇ ਆਧੁਨਿਕ ਰੂਪ ਧਾਰਨ ਕੀਤਾ ਅੱਜ ਕੱਲ ਪੰਜਾਬੀ ਭਾਸ਼ਾ ਨੂੰ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਬੋਲਿਆ ਜਾਂਦਾ ਹੈ